ਹਾਂ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਗੱਲ ਹੋਰ ਕੀ ਹਾਲ ਚਾਲ ਨੇ ਵਾ ਭੈਣ ਜੀ ਆ ਮੈਂ ਗੱਲ ਕਰਨੀ ਸੀ ਵੀ ਆਹ ਆਪਣੇ ਤਰਨਤਾਰਨ ਦੇ ਲੋਕ ਬਾਹਰ ਕਿਉਂ ਜਾਈ ਜਾਂਦੇ ਆ ਜੀ

ਆਹੋ ਹੁਣ ਮੈਂ ਆਹ ਹੀ ਦੇਖਦਾ ਪਿਆ ਉਹ ਹੀ ਮੈਂ ਦੇਖਦਾ ਪਿਆਂ ਇੱਥੇ ਕਿ ਤਰਨਤਾਰਨ ਸਾਰੇ ਹੀ ਜਿੰਨੇ ਵੀ ਆ ਕਿਸੇ ਦੇ ਦੋ ਬੱਚੇ ਆ ਦੋਨੋਂ ਦੇ ਦੋਨੋਂ ਹੀ ਭੇਜੇ ਆ ਕਈਆਂ ਘਰਾਂ ਚੋਂ ਜੇ ਇੱਕ ਜਾ ਚੁੱਕਾ ਅਤੇ ਦੂਜਾ ਤਿਆਰੀ ਵਿੱਚ ਹੈਗਾ ਵੀ ਹਾਂ ਇਹਨੂੰ ਵੀ ਭੇਜ ਦੇਈਏ ਕਿਉਂਕਿ ਵੇਖਦੇ ਪਏ ਉੱਥੇ ਤਰੱਕੀ ਹੈ ਇੱਥੇ ਨਸ਼ੇ ਬੜੇ ਆ ਤਾਂ ਫਿਰ ਬੱਚੇ ਆਪਣੇ ਮੁੰਡਿਆਂ ਨੂੰ ਬਚਾਉਣ ਲਈ ਫਿਰ ਕਹਿੰਦੇ ਆ ਕਿ ਚਲੋ ਉੱਥੇ ਹੀ ਭੇਜ ਦਿੰਦੇ ਹਾਂ ਅਸੀਂ ਹੈ ਨਾ ਉਹ ਵਿਚਾਰੇ ਆਪ ਸੱਚੀ ਦੁਖੀ ਆ ਹਾਂ ਚਲੋ ਫਿਰ ਠੀਕ ਹੈ ਹਾਂ ਹਾਂ ਹਾਂ